ਗਾਉਣ ਦਾ ਪ੍ਰਦਰਸ਼ਨ ਦਿੰਦੇ ਸਮੇਂ ਸਾਡੇ ਸਰੀਰ ਅਤੇ ਚਿਹਰੇ ਦੇ ਹਾਵ ਪ੍ਰਭਾਵ ਬਹੁਤ ਹੀ ਅਹਿਮ ਭੂਮਿਕਾ ਅਦਾ ਕਰਦੇ ਹਨ ਸਾਡੇ ਸਰੀਰ ਅਤੇ ਚਿਹਰੇ ਦੀ ਇਹ ਹਾਵ ਪ੍ਰਭਾਵ ਦੀ ਵਰਤੋਂ ਕਰਕੇ ਅਸੀਂ ਆਪਣੇ ਗਾਉਣ ਦਾ ਪ੍ਰਦਰਸ਼ਨ ਨਿਖਾਰ ਸਕਦੇ ਹਾਂ ਸਾਡੇ ਇਹੀ ਹਾਵ ਪ੍ਰਭਾਵ ਸਾਡੇ ਦਰਸ਼ਕਾਂ ਨੂੰ ਸਾਡੇ ਵੱਲ ਆਕਰਸ਼ਿਤ ਕਰਦੇ ਹਨ ਉਹਨਾਂ ਵਾਸਤੇ ਇਹ ਇੱਕ ਖਿੱਚ ਦਾ ਕੇਂਦਰ ਬਣਦੇ ਹਨ ਇਹਨਾਂ ਦੀ ਮਦਦ ਨਾਲ ਅਸੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰ ਸਕਦੇ ਹਾਂ ਅਸੀਂ ਬਿਹਤਰ ਆਵਾਜ਼ਾਂ ਲਈ ਸਾਨੂੰ ਹਰ ਰੋਜ਼ ਅਭਿਆਸ ਕਰਨਾ ਚਾਹੀਦਾ ਹੈ ਗਾਉਣ ਤੋਂ ਪਹਿਲਾਂ ਸਾਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਕਿ ਸਾਡੇ ਗਾਉਣ ਦੇ ਪ੍ਰਦਰਸ਼ਨ ਨੂੰ ਖਰਾਬ ਕਰਨ ਖਾਸ ਕਰਕੇ ਸਾਨੂੰ ਖੱਟਾ ਜਾਂ ਕੋਈ ਵੀ ਕਿਸੇ ਪ੍ਰਕਾਰ ਦਾ ਮਸਾਲੇਦਾਰ ਭੋਜਨ ਨਹੀਂ ਖਾਣਾ ਚਾਹੀਦਾ ਜਿਸ ਕਾਰਨ ਸਾਨੂੰ ਗਾਉਣ ਵਿੱਚ ਕਿਸੇ ਵੀ ਪ੍ਰਕਾਰ ਦੀ ਦਿੱਕਤ ਜਾਂ ਪਰੇਸ਼ਾਨੀ ਆਵੇ ਅਜਿਹੀਆਂ ਚੀਜ਼ਾਂ ਤੋਂ ਸਾਨੂੰ ਗੁਰੇਜ ਕਰਨਾ ਚਾਹੀਦਾ ਹੈ ਪਰਦਰਸ਼ਨ ਕਰਨ ਤੋਂ ਪਹਿਲਾਂ ਗਰਮ ਪਾਣੀ ਦੇ ਗਰਾਰੇ ਕਰ ਲੈਣੇ ਚਾਹੀਦੇ ਹਨ ਗਰਮ ਪਾਣੀ ਦੇ ਗਰਾਰੇ ਕਰਨ ਨਾਲ ਸਾਨੂੰ ਵਧੀਆ ਪ੍ਰਦਰਸ਼ਨੀ ਕਰਨ ਵਿੱਚ ਸਹਾਇਤਾ ਹੁੰਦੀ ਹੈ ਸਾਡੇ ਚਿਹਰੇ 'ਤੇ ਹਾਵ ਪ੍ਰਭਾਵ ਸਾਡੇ ਦਰਸ਼ਕਾਂ ਨੂੰ ਸਾਡੇ ਵੱਲ ਬਹੁਤ ਜ਼ਿਆਦਾ ਹੱਦ ਤੱਕ ਪ੍ਰਭਾਵਿਤ ਕਰਦੇ ਹਨ ਇਹ ਉਹਨਾਂ ਲਈ ਇੱਕ ਖਿੱਚ ਦਾ ਕੇਂਦਰ ਬਣਦੇ ਹਨ ਉਹਨਾਂ ਨੂੰ